ਹੈਲੋ ਸਤਿ ਸ਼੍ਰੀ ਅਕਾਲ ਜੀ ਲਖਵੀਰ ਸਿੰਘ ਜੀ ਮੈ ਹਰਿਆਣੇ ਤੋਂ ਬੋਲ ਰਿਹਾ ਜੀ ਮੈਨੂੰ ਪੰਜਾਬ ਘੁੰਮਣ ਆਉਣਾ ਸੀ ਜੀ ਮੈਂ ਮੈਨੂੰ ਤੁਹਾਡੇ ਫਰੈਂਡ ਨੇ ਨੰਬਰ ਦਿੱਤਾ ਸੀ ਕਹਿੰਦੇ ਵੀ ਉਹਨਾਂ ਨਾਲ ਗੱਲ ਕਰ ਲਿਓ ਤੁਸੀਂ ਘੁੰਮਣਾ ਪੰਜਾਬ ਅਤੇ

ਨਾ ਵੈਸੇ ਤਾਂ ਮੈਂ ਇਕੱਲਾ ਹੀ ਆਊਂਗਾ ਜੀ ਹਲੇ ਇੱਕ ਵਾਰੀ ਘੁੰਮ ਕੇ ਫਿਰ ਬੱ ਬੱਚਿਆਂ ਨੂੰ ਫਿਰ ਲਿਆਵਾਂਗੇ ਪਹਿਲਾਂ ਮੈਂ ਮੈਂ ਸੋਚਿਆ ਦੇਖ ਲਈਏ

ਅੱਛਾ ਮੈਂ ਹਾਂ ਫਤਿਹ ਫਤਿਹਗੜ੍ਹ ਘੁੰਮਣ ਆਉਣਾ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਹਮ ਅੱਛਾ ਜੀ ਹੁਣ ਹੁਣ ਮ ਅੱਛਾ ਜੀ ਹੁਣ ਮੌਸਮ ਕਿਵੇਂ ਆ ਜੀ ਉਰੇ ਮੌਸਮ ਅੱਛਾ ਜੀ ਹੁਣ ਕੱਪੜੇ ਤਾਂ ਫਿਰ ਮੋਟੇ ਓ ਚੱਕਣੇ ਪੈਣਗੇ ਜੀ ਮੈਨੂੰ ਭਾਰੀ ਹਮ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਮੈਂ ਸੁਣਿਆ ਤਾ ਜੀ ਕਹਿੰਦੇ ਆਮ ਖਾਸ ਬਾਗ ਵੀ ਆ ਜੀ ਉਰੇ ਕਹਿੰਦੇ ਘੁੰਮਣ ਨੂੰ ਵਧੀਆ ਏ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਠੀਕ ਹੈ ਹੁਣ ਕਹਿੰਦੇ ਜੀ ਆਹਾ ਬਾਰ੍ਹਵੇਂ ਮਹੀਨੇ ਦੀ ਛੱਬੀ ਅਤੇ ਸਤਾਈ ਅਠਾਈ ਤੋਂ ਸ਼ਹੀਦੀ ਜੋੜ ਮੇਲਾ ਵੀ ਸ਼ੁਰੂ ਹੋਣਾ ਜੀ ਕਹਿੰਦੇ ਮੈਂ ਨਾਲੇ ਚੱਲ ਉਹ ਵੀ ਦੇਖ ਆਵਾਂਗੇ ਜੀ ਨਾਲੇ ਫਿਰ ਤੁਸੀਂ ਤੁਸੀਂ ਨਾਲ ਹੋ ਕੇ ਦੱਸਿਓ ਵੀ ਇਤਿਹਾਸ ਹੈ ਜੀ ਉਰੇ ਦਾ ਫਤਿਹਗੜ੍ਹ ਦਾ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਚੰਗਾ ਜੀ ਓਕੇ ਜੀ ਠੀਕ ਆ ਜੀ